ਸਾਡੇ ਪੰਜਾਬ ਰਾਜ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਹਿੰਦੂ ਮੁਸਲਿਮ ਸਿੱਖ ਈਸਾਈ ਇਹਨਾਂ ਧਰਮਾਂ ਦੇ ਆਪਣੇ ਆਪਣੇ ਆਗੂ ਹਨ ਜੋ ਆਪਣੇ ਧਰਮਾਂ ਦੀ ਧਰਮਾਂ ਦਾ ਗਿਆਨ ਦਿੰਦੇ ਹਨ ਹਿੰਦੂਆਂ ਦੇ ਪੁਜਾਰੀ ਹਨ ਜੋ ਮੰਦਰਾਂ ਵਿੱਚ ਆਰਤੀ ਅਤੇ ਹਵਨ ਕਰਦੇ ਹਨ ਈਸਾਈ ਲੋਕਾਂ ਦੇ ਪਾਸਟਰ ਘਰ ਆ ਕੇ ਦੁਆ ਕਰਦੇ ਹਨ ਅਤੇ ਭਜਨ ਗਾਏ ਜਾਂਦੇ ਹਨ ਭਿਕਸ਼ੂ ਜੋ ਅਤੇ ਸਾਧੂ ਲੋਕ ਭੋਜਨ ਦੀ ਭਿਕਸ਼ਾ ਮੰਗਦੇ ਹਨ ਅਤੇ ਦੁਆਵਾਂ ਦਿੰਦੇ ਹਨ ਇਹ ਸਾਧੂ ਜੰਗਲਾਂ ਵਿੱਚ ਭਗਵਾਨ ਦਾ ਸਿਮਰਨ ਦਾ ਜਾਪ ਕਰਦੇ ਹਨ ਮੈਂ ਸਿੱਖ ਪਰਿਵਾਰ ਨਾਲ ਸੰਬੰਧਿਤ ਹਾਂ ਸਾਡੇ ਧਰਮ ਦੇ ਆਗੂ ਜਿਵੇਂ ਗਿਆਨੀ ਪਿੰਦਰਪਾਲ ਜੀ ਭਾਈ ਮਨਦੀਪ ਸਿੰਘ ਜੀ ਗੁਰਇਕਬਾਲ ਸਿੰਘ ਜੀ ਹੋਰ ਵੀ ਕਈ ਸ਼ਖਸੀਅਤਾਂ ਅਤੇ ਜਿਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਮੈਨੂੰ ਭਾਈ ਪਿੰਦਰਪਾਲ ਸਿੰਘ ਜੀ ਕਥਾ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ ਉਹਨਾਂ ਸਾਨੂੰ ਨਾਮ ਜਪਣ ਅਤੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਹੈ